ਮੇਰੀ ਸਭ ਤੋਂ ਮਨ ਪਸੰਦ ਕਿਤਾਬ ਜਿਸ ਦਾ ਨਾਂ ਕਿ ਸੰਤ ਮਾਰਗ ਹੈ ਜੋ ਕਿ ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਲਿਖੀ ਗਈ ਹੈ ਮੈਂ ਉਸ ਵਿੱਚ ਸਭ ਤੋਂ ਵਧੀਆ ਗੱਲ ਜਿਹੜੀ ਕਿ ਮੈਨੂੰ ਇਹ ਲੱਗੀ ਹੈ ਕਿ ਉਸ ਵਿੱਚ ਇਹ ਦੱਸਿਆ ਹੈ ਕਿ ਸਾਨੂੰ ਹਮੇਸ਼ਾ ਜਿਹੜਾ ਹੈ ਉਹ ਸੱਚ ਬੋਲਣਾ ਚਾਹੀਦਾ ਹੈ ਅਤੇ ਝੂਠ ਦੇ ਕਦੇ ਵੀ ਪੈਰ ਨਹੀਂ ਹੁੰਦੇ ਸਾਨੂੰ ਹਮੇਸ਼ਾ ਸੱਚ ਦਾ ਹੀ ਹੱਥ ਫੜਨਾ ਚਾਹੀਦਾ ਹੈ ਅਤੇ ਸਾਨੂੰ ਗੁਰੂ ਦੇ ਚੱਲੇ ਹੋਏ ਕਦਮਾਂ 'ਤੇ ਹੀ ਹਮੇਸ਼ਾ ਚੱਲਣਾ ਚਾਹੀਦਾ ਹੈ ਕਦੇ ਕਿਸੇ ਦੇ ਨਾਲ ਉੱਚੀ ਨੀਵੀਂ ਨਹੀਂ ਬੋਲਣੀ ਚਾਹੀਦੀ ਅਤੇ ਆਪਣੇ ਬੱਚਿਆਂ ਨੂੰ ਵੀ ਇੱਦਾਂ ਦੇ ਹੀ ਸੰਸਕਾਰ ਦੇਣੇ ਚਾਹੀਦੇ ਹਨ ਤਾਂ ਕਿ ਜੋ ਉਹ ਵੱਡਿਆਂ ਵੱਡਿਆਂ ਦੀ ਵੱਡਿਆਂ ਦਾ ਮਾਨ ਸਤਿਕਾਰ ਜਿਹੜਾ ਹੈ ਅਤੇ ਉਹਨਾਂ ਦੀ ਇੱਜਤ ਕਰ ਸਕਣ ਅਤੇ ਨਾਲ ਦੇ ਨਾਲ ਮੈਨੂੰ ਇਹ ਵੀ ਬਹੁਤ ਵਧੀਆ ਉਸ ਵਿੱਚੋਂ ਮੈਸੇਜ ਮਿਲਿਆ ਕਿ ਤੁਹਾਨੂੰ ਸਾਨੂੰ ਹਮੇਸ਼ਾ ਉਹਨਾਂ ਦੀਆਂ ਗੱਲਾਂ ਨੂੰ ਹੀ ਫੋਲੋ ਕਰਨਾ ਚਾਹੀਦਾ ਹੈ ਸਾਨੂੰ ਮਨਮੁਖ ਨਹੀਂ ਭਾਵ ਕਿ ਸਾਨੂੰ ਗੁਰਮੁਖ ਜਿਹੜਾ ਹੈ ਉਹ ਬਣਨਾ ਚਾਹੀਦਾ ਹੈ